ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ ਅਤੇ ਮੈਂ ਅਲੱਗ ਅਲੱਗ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੀ ਹੀ ਰਹਿੰਦੀ ਹਾਂ ਪਰ ਮੈਨੂੰ ਕੁਝ ਕਿਤਾਬਾਂ ਹਨ ਜੋ ਬਹੁਤ ਵਧੀਆ ਲੱਗਦੀਆਂ ਹਨ ਜਿਨ੍ਹਾਂ ਵਿੱਚ ਇੱਕ ਕਿਤਾਬ ਹੈ ਚਾਣਕਿਆ ਨੀਤੀ ਜਿਸ ਨਾਲ ਮੈਨੂੰ ਪਤਾ ਲੱਗਾ ਕਿ ਸਾਡੇ ਆਪਣੇ ਉੱਚ ਵਿਚਾਰਾਂ ਨੂੰ ਆਪਾਂ ਰੱਖ ਕੇ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਾਂ ਵਧੀਆ ਕਰ ਸਕਦੇ ਹਾਂ ਅਤੇ ਉਸ ਤੋਂ ਮੈਨੂੰ ਪਤਾ ਲੱਗਾ ਕਿ ਆਪਾਂ ਆਪਣੀ ਸੋਚ ਦੇ ਨਾਲ ਕੋਈ ਵੀ ਮੁਕਾਮ ਹਾਸਿਲ ਕਰ ਸਕਦੇ ਹਾਂ ਅਤੇ ਦੂਜੀ ਕਿਤਾਬ ਜੋ ਮੈਨੂੰ ਸਭ ਤੋਂ ਵਧੀਆ ਲੱਗਦੀ ਹੈ ਉਹ ਹੈਗੀ ਹੈ ਛੋਟੀਆਂ ਨਿੱਕੀਆਂ ਜਿੰਦਾਂ ਵੱਡਾ ਸਾਕਾ ਇਹ ਕਿਤਾਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਹੈ ਉਹਨਾਂ ਦੀ ਕਹਾਣੀ ਦੱਸਦੀ ਹੈ ਇਸ ਵਿੱਚ ਕਿਹਾ ਜਾਂਦਾ ਹੈ ਕਿ ਜੋ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ ਵਜ਼ੀਰ ਖਾਨ ਵੱਲੋਂ ਉਹ ਉਹਨਾਂ ਦੀ ਉਮਰ ਇੱਕ ਦੀ ਉਮਰ ਨੌਂ ਸਾਲ ਦੀ ਸੀ ਅਤੇ ਇੱਕ ਦੀ ਉਮਰ ਛੇ ਸਾਲ ਦੀ ਸੀ ਇੰਨੀ ਨਿੱਕੀ ਉਮਰ ਵਿੱਚ ਵੀ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਅਤੇ ਆਪਣੇ ਧਰਮ ਦੇ ਨਾਲ ਨਾਲ ਲੜਦੇ ਲੜਦੇ ਸ਼ਹੀਦੀਆਂ ਪ੍ਰਾਪਤ ਕਰ ਗਏ ਜਦੋਂ ਉਹ ਛੋਟੇ ਛੋਟੇ ਸਨ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਅਤੇ ਬਹੁਤ ਤਸੀਹੇ ਦਿੱਤੇ ਗਏ ਉਹਨਾਂ ਦੇ ਚੈ ਉਹਨਾਂ ਨੂੰ ਗੁਲੇਲਾਂ ਨਾਲ ਮਾਰਿਆ ਗਿਆ ਅਤੇ ਉਹਨਾਂ ਨੇ ਜਦੋਂ ਵਜ਼ੀਰ ਖਾਨ ਦੇ ਕੋਲ ਘੱਲਿਆ ਗਿਆ ਤਾਂ ਉੱਥੇ ਵੀ ਉਹਨਾਂ ਨੂੰ ਬੜੇ ਲਾਲਚ ਦਿੱਤੇ ਗਏ ਅਤੇ ਬੜੀਆਂ ਕੁਛ ਕਿਹਾ ਗਿਆ ਕਿ ਉਹ ਆਪਣੇ ਧਰਮ ਨੂੰ ਬਦਲ ਦੇਣ ਉਹਨਾਂ ਨੂੰ ਇੱਥੋਂ ਤੱਕ ਡਰਾਵੇ ਦਿੱਤੇ ਗਏ ਕਿ ਉਹਨਾਂ ਨੂੰ ਮਾਰ ਵੀ ਦਿੱਤਾ ਜਾਵੇਗਾ ਉਹਨਾਂ ਦਾ ਸਾਰਾ ਪਰਿਵਾਰ ਖ਼ਤਮ ਕਰ ਦਿੱਤਾ ਜਾਵੇਗਾ ਉਹਨਾਂ ਦੇ ਵੱਡੇ ਵੀਰਾਂ ਨੂੰ ਵੀ ਮਾਰ ਦਿੱਤਾ ਜਾਵੇਗਾ ਪਰ ਉਹਨਾਂ ਨੇ ਆਪਣਾ ਹੌਂਸਲਾ ਨਹੀਂ ਛੱਡਿਆ ਅਤੇ ਆਪਣੇ ਧਰਮ 'ਤੇ ਅੜ੍ਹੇ ਰਹੇ ਉਹਨਾਂ ਨੇ ਹਰ ਮੁਸੀਬਤ ਨੂੰ ਝੱਲਦਿਆਂ ਹੋਇਆਂ ਅਤੇ ਹਰ ਲਾਲਚ ਨੂੰ ਪਰਾਂ ਕਰਦੇ ਹੋਇਆ ਆਪਣੇ ਧਰਮ ਨੂੰ ਬਚਾਇਆ ਅਤੇ ਆਪਣੇ ਧਰਮ ਦੇ ਲਈ ਖੜ੍ਹੇ ਰਹੇ ਅਤੇ ਆਖਰੀ ਦੇ ਵਿੱਚ ਉਹਨਾਂ ਨੇ ਆਪਣੇ ਧਰਮ ਸਥਾਪਨਾ ਕੀਤੀ ਅਤੇ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਅਸੂਲਾਂ ਉੱਤੇ ਅਮਲ ਕੀਤਾ ਅਤੇ ਅੱਜ ਇੱਕ ਸਾਡੇ ਲਈ ਮਿਸਾਲ ਖੜ੍ਹੀ ਕਰ ਗਏ ਕਿ ਸਾਡੇ ਲਈ ਕੋਈ ਵੀ ਧਰਮ ਤੋਂ ਵੱਡੀ ਹੋਰ ਕੋਈ ਚੀਜ਼ ਨਹੀਂ ਹੈ ਇੱਥੇ ਧਰਮ ਤੋਂ ਉੱਤੇ ਸਾਡੇ ਵਾਸਤੇ ਕੁਛ ਵੀ ਨਹੀਂ ਹੋ ਸਕਦਾ ਤੇ ਲਾਲਚ ਮੋਹ ਸਭ ਇਹ ਦੁਨੀਆ 'ਤੇ ਹੀ ਰਹਿ ਜਾਣਾ ਹੈ ਅਤੇ ਅਸਲ ਦੇ ਵਿੱਚ ਸਾਡੇ ਕੋਲ ਇੱਕ ਪਰਮਾਤਮਾ ਦਾ ਹੀ ਨਾਮ ਰਹਿ ਜਾਂਦਾ ਹੈ ਅਤੇ ਅਸੀਂ ਆਪਣੇ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਆਪਣੇ ਧਰਮ ਦੇ ਨਾਲ ਚੱਲਦੇ ਰਹੇ ਉਹ ਹੀ ਰਹਿ ਜਾਂਦਾ ਹੈ